ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਕਈ ਐਸੇ ਸਥਾਨਕ ਸਿੱਖਿਆ ਹੈ ਜਿੱਥੇ ਬੱਚੇ ਪੜ੍ਹ ਲਿਖ ਕੇ ਅਤੇ ਕੁਝ ਸਿੱਖ ਕੇ ਆਪਣੇ ਜੀਵਨ ਨੂੰ ਮੁਕੰਮਲ ਕਰਦੇ ਹਨ ਅਤੇ ਸਫਲ ਹੁੰਦੇ ਹਨ ਜਿਵੇਂ ਕਿ ਪਠਾਨਕੋਟ ਵਿੱਚ ਕਈ ਮਹਾਨ ਕੋਲਜ ਸਕੂਲ ਹਨ ਜਿੱਥੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਨੇ ਅਤੇ ਪੜ੍ਹਨ ਤੋਂ ਇਲਾਵਾ ਸਕੂਲਾਂ ਵਿੱਚ ਬੱਚਿਆਂ ਨੂੰ ਹੋਰ ਵੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਕਿ ਖੇਡਾਂ ਕਰੋ ਖੇਡਾਂ ਕਰਵਾਉਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਬੱਚਿਆਂ ਨੂੰ ਡਰਾਇੰਗ ਸਿਖਾਉਂਦੇ ਨੇ ਸਵਿਮਿੰਗ ਦੀ ਸਿੱਖਿਆ ਦਿੰਦੇ ਨੇ ਅਤੇ ਹੋਰ ਵੀ ਕਈ ਐਸੀ ਸਿੱਖਿਆਵਾਂ ਦਿੰਦੇ ਹਨ ਜਿਹਨਾਂ ਦਾ ਬ ਜਿਹਨਾਂ ਜਿਹਨਾਂ ਵਿੱਚ ਬੱਚੇ ਸਫਲ ਹੋ ਪਾਉਣ ਸਾਡੇ ਇੱਥੇ ਕਈ ਚੰਗੇ ਸਕੂਲ ਹਨ ਜਿਵੇਂ ਕਿ ਅਕਾਲ ਅਕੈਡਮੀ ਆਰਮੀ ਸਕੂਲ ਮੈਂਟੈਂਸਰੀ ਕ੍ਰਾਈਸਟ ਦ ਕਿੰਗ ਸੈਂਟ ਮੈਰੀ ਸਪ੍ਰਿੰਗਡੇਲ ਕੇਂਦਰ ਵਿੱਦਿਆਲਿਆ ਅਤੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਅਲੱਗ ਅਲੱਗ ਥਾਵਾਂ 'ਤੇ ਸਕੂਲ ਖੁੱਲ੍ਹੇ ਹਨ ਜੋ ਬੱਚਿਆਂ ਨੂੰ ਬਹੁਤ ਚੰਗੀਆਂ ਸੁਵਿਧਾਵਾਂ ਪ੍ਰਾਪਤ ਕਰਵਾਉਂਦੇ ਹਨ ਇਹਨਾਂ ਸਭ ਦਾ ਇਹਨਾਂ ਸਭ ਸਕੂਲਾਂ ਦੀ ਫੀਸ ਫੀਸ ਸਟਰਕਚਰ ਹਰ ਇੱਕ ਨਾਲੋਂ ਅਲੱਗ ਅਲੱਗ ਹੈ ਕਈ ਸਕੂਲਾਂ ਵਿੱਚ ਫੀਸ ਜ਼ਿਆਦਾ ਹੈ ਅਤੇ ਕਈ ਸਕੂਲਾਂ ਵਿੱਚ ਫੀਸ ਬਹੁਤ ਹੀ ਘੱਟ ਹਨ ਕਈ ਬੱਚੇ ਇਹਨਾਂ ਸਕੂਲਾਂ ਵਿੱਚ ਨਹੀਂ ਪੜ੍ਹ ਸਕਦੇ ਕਿਉਂਕਿ ਉੱਥੋਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਉਸ ਫੀਸ ਨੂੰ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਸਰਕਾਰ ਨੇ ਸਰਕਾਰੀ ਸਕੂਲ ਖੋਲ੍ਹੇ ਹਨ ਜਿੱਥੇ ਫੀਸ ਬਹੁਤ ਹੀ ਘੱਟ ਹੈ ਪਰ ਉੱਥੋਂ ਦੇ ਅਧਿਆਪਕ ਬਹੁਤ ਹੀ ਪੜ੍ਹੇ ਲਿਖੇ ਅਤੇ ਗਿਆਨ ਵਾਲੇ ਹਨ ਜੋ ਬੱਚਿਆਂ ਨੂੰ ਸਿੱਧੇ ਰਾਹ ਪਾਉਂਦੇ ਨੇ ਅਤੇ ਪੜ੍ਹ ਲਿਖ ਕੇ ਮਹਾਨ ਬਣਾਉਂਦੇ ਨੇ ਇਹ ਤਾਂ ਹੋ ਗਈ ਗੱਲ ਸਾਡੇ ਇੱਥੋਂ ਦੇ ਸਕੂਲ ਬਾਰੇ ਹੁਣ ਮੈਂ ਗੱਲ ਕਰਾਂਗੀ ਕੋਲਜਾਂ ਬਾਰੇ ਸਕੂਲ ਦੇ ਨਾਲ ਨਾਲ ਇੱਥੇ ਕਈ ਐਸੇ ਕੋਲਜ ਹਨ ਜੋ ਬਹੁਤ ਹੀ ਮਹਾਨ ਨੇ ਅਤੇ ਬੱਚਿਆਂ ਨੂੰ ਸ਼ੁੱਧ ਸਿੱਖਿਆ ਅਤੇ ਸਿੱਖਿਆਵਾਂ ਦਿੰਦੀ ਹੈ ਜਿਵੇਂ ਕਿ ਪਠਾਨਕੋਟ ਵਿੱਚ ਕਈ ਕੋਲਜ ਹਨ ਜਿਵੇਂ ਕਿ ਜੀ ਐਨ ਡੀ ਯੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲਜ ਬੇਅੰਤ ਕੋਲਜ ਇੰਜੀਨੀਅਰਿੰਗ ਕੋਲਜ ਆਰਿਆ ਕੋਲਜ ਅਤੇ ਹੋਰ ਵੀ ਬਹੁਤ ਸਾਰੇ ਕੋਲਜ ਹਨ ਇਹਨਾਂ ਸਭ ਕੋਲਜਾਂ ਦੀ ਫੀਸ ਵੀ ਅਲੱਗ ਅਲੱਗ ਹੁੰਦੀ ਹਨ ਕਈ ਕੋਲਜ ਪ੍ਰਾਈਵੇਟ ਹਨ ਅਤੇ ਕਈ ਕੋਲਜ ਸਰਕਾਰੀ ਹਨ ਜਿਹੜੇ ਬੱਚੇ ਫੀਸ ਨਾ ਦੇ ਪਾਉਣ ਘੱਟ ਫੀਸ ਦੇ ਪਾਉਣ ਜਾਂ ਜਿਹਨਾਂ ਕੋਲ ਫੀਸ ਦੇਣ ਜੋਗੇ ਘੱਟ ਪੈਸੇ ਹੋਣ ਉਹ ਬੱਚੇ ਸਰਕਾਰੀ ਕੋਲਜ ਨੂੰ ਅਫੋਰਡ ਕਰਦੇ ਹਨ ਸਰਕਾਰੀ ਕੋਲਜ ਵੀ ਸਰਕਾਰੀ ਕੋਲਜ ਸਰਕਾਰੀ ਸਕੂਲਾਂ ਵਾਂਗ ਬਹੁਤ ਹੀ ਵਧੀਆ ਹੁੰਦੇ ਨੇ ਅਤੇ ਅਤੇ ਇਹ ਬੱਚਿਆਂ ਨੂੰ ਸ਼ੁੱਧ ਸਿੱਖਿਆ ਪ੍ਰਾਪਤ ਕਰਵਾਉਂਦੇ ਨੇ ਇਹ ਤਾਂ ਹੋ ਗਈ ਕੋਲਜਾਂ ਬਾਰੇ ਹੁਣ ਸਾਡੇ ਪਠਾਨਕੋਟ ਵਿੱਚ ਕਈ ਐਸੀ ਇੰਸਟੀਟਿਊਟਸ ਵੀ ਹਨ ਜੋ ਬੱਚਿਆਂ ਨੂੰ ਕੋਚਿੰਗ ਪ੍ਰੋਵਾਈਡ ਕਰਵਾਉਂਦੇ ਹਨ ਜਿਵੇਂ ਕਿ ਕਈ ਬੱਚੇ ਪਲੱਸ ਟੂ ਦੇ ਬਾਅਦ ਜੇਈ ਮੀਨ ਦੀ ਜਾਂ ਫਿਰ ਨੀਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਜਾਂ ਕੰਪਿਊਟਰ ਕੋਚਿੰਗ ਲੈਣਾ ਚਾਹੁੰਦੇ ਨੇ ਇਹਨਾਂ ਲਈ ਵੀ ਕਈ ਸਾਰੀ ਥਾਵਾਂ ਖੁੱਲ੍ਹੀ ਖੋਲ੍ਹੀਆਂ ਹਨ ਸਰਕਾਰ ਨੇ ਅਤੇ ਕਈ ਪ੍ਰਾਈਵੇਟ ਥਾਵਾਂ ਵੀ ਹਨ ਜਿਵੇਂ ਕਿ ਕੋਈ ਪਠਾਨਕੋਟ ਵਿੱਚ ਹਨ ਆਈ ਏ ਐਸ ਅਤੇ ਹੋਰ ਵੀ ਹਨ ਬਹੁਤ ਸਾਰੀਆਂ ਇਹ ਇੱਥੇ ਸਾਰੇ ਬੱਚਿਆਂ ਨੂੰ ਸ਼ੁੱਧ ਸਿੱਖਿਆ ਪ੍ਰਾਪਤ ਕਰਵਾਉਂਦੇ ਹਨ ਅਤੇ ਸਫਲ ਬਣਾਉਂਦੇ ਹਨ